ਹਾਂ ਆਪਣੇ ਖੇਤਰ 'ਚ ਅੰਤਰ ਭਾਈਚਾਰਕ ਲੜਾਈਆਂ ਆਮ ਹੀ ਨੇ ਅੱਜ ਸਾਡੀਆਂ ਜਿਹੜੀਆਂ ਲੜਾਈਆਂ ਨੇ ਕਿਸੇ ਦੂਸਰੇ ਦੇਸ਼ਾਂ ਨਾਲ ਬਲ ਨਹੀ ਹੈਗੀਆਂ ਅਨ ਆਪਣੇ ਇੱਥੇ ਹੀ ਨੇ ਇੱਕ ਸਿੱਖ ਉਹ ਸਿੱਖ ਦੇ ਨਾਲ ਹੀ ਲੜੀ ਜਾਂਦਾ ਇੱਕ ਪੰਜਾਬੀ ਉਹ ਪੰਜਾਬੀ ਦੇ ਨਾਲ ਹੀ ਲੜੀ ਜਾਂਦਾ ਇਹ ਚੁਲ ਚੱਲੀ ਜਾ ਰਿਹਾ ਸ਼ੁਰੂ ਤੋਂ ਹੀ ਐਵੇਂ ਚੱਲੀ ਜਾਂਦਾ ਕਿੰਨੇ ਹੀ ਸਾਲ ਹੋ ਚੱਲੇ ਨੇ ਇੱਕ ਨੂੰ ਦੂਸਰਾ ਚੰਗਾ ਹੀ ਨਹੀਂ ਲੱਗਦਾ ਜਿਵੇਂ ਕਿ ਹੁਣ ਤੁਸੀਂ ਪੰਜਾਬ ਦੇ ਵਿੱਚ ਹੀ ਲਾ ਲਓ ਕਿੰਨੀਆਂ ਹੀ ਪਾਰਟੀਆਂ ਬਣਾਈਆਂ ਪਈਆਂ ਨੇ ਸਿੱਖ ਨੇ ਉਹਨਾਂ ਨੇ ਆਪਣੀਆਂ ਹੀ ਕਿੰਨੀਆਂ ਕੁ ਬਣਾਈਆਂ ਪਈਆਂ ਨੇ ਹਿੰਦੂ ਨੇ ਉਹ ਅਲੱਗ ਅਲੱਗ ਅਲੱਗ ਅਲੱਗ ਪਾਰਟੀਆਂ ਬਣਗਈਆਂ ਆਪਸ ਦੇ ਵਿੱਚ ਲੜੀ ਜਾਂਦੇ ਨੇ ਉਹ ਕਹਿੰਦਾ ਮੈਂ ਤੇਰੇ ਤੋਂ ਤਾਕਤਵਰ ਹਾਂ ਉਹ ਕਹਿੰਦਾ ਮੈਂ ਤੇਰੇ ਤੋਂ ਤਾਕਤਵਰ ਹਾਂ ਮੇਰੇ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਇਹਦੇ ਨਾਲ ਹੋਇਆ ਹੈ ਥੋੜ੍ਹਾ ਜਿਹਾ ਪ੍ਰਭਾਵ ਅਨੁਭਵ ਕੀਤਾ ਮੈਂ ਵੀ ਨਤੀਜਾ ਵੀ ਹੋਇਆ ਥੋੜ੍ਹਾ ਜਿਹਾ ਕਿ ਮਤਲਬ ਲੋਕ ਵੇਖਣ ਲੱਗ ਜਾਂਦੇ ਨੇ ਵੀ ਇਹ ਕਿਹੜੀ ਪਾਰਟੀ ਦਾ ਇਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ ਇਹਦੇ ਨਾਲ ਚੰਗੇ ਤਰੀਕੇ ਨਾਲ ਬੋਲਣਾ ਕਿ ਨਹੀਂ ਬੋਲਣਾ ਅੱਛਾ ਜੇ ਮਾੜਾ ਜਿਹਾ ਕਿਸੇ ਨੂੰ ਚੰਗਾ ਕਹਿ ਦਿਓ ਕਿ ਇਹ ਬੰਦੇ ਵਧੀਆ ਕਰਦੇ ਨੇ ਤਾਂ ਉਹ ਸਾਨੂੰ ਰਿਲੇਟ ਹੀ ਕਰਨ ਲੱਗ ਜਾਂਦੇ ਨੇ ਕਿ ਇਹ ਤਾਂ ਉਸ ਪਾਰਟੀ ਦਾ ਹੀ ਬੰਦਾ ਹੋਣਾ ਇਹਦੇ ਨਾਲ ਥੋੜ੍ਹਾ ਦੁਖੀ ਵੀ ਹੁੰਦਾ ਮਨ ਕਈ ਵਾਰ